ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ

ਇਹ ਜੇ ਗੁਰੂ ਨਾਨਕ ਬਾਬਾ ਜੀ ਦਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਜੀ ਇੱਕ ਘੰਟੇ ਦਾ ਹੈਗਾ ਜੇ ਰ ਰਸਤਾ ਇੱਕ ਘੰਟੇ ਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬੱਸਾਂ ਚੱਲਦੀਆਂ ਤੁਹਾਨੂੰ ਬ ਬੱਸ ਸਟੈਂਡ ਤੋਂ ਬੱਸ ਮਿਲ ਜਾਏਗੀ ਹਾਂਜੀ ਹਾਂਜੀ ਹਾਂਜੀ ਗੁਰਦਾਸਪੁਰ ਤੋਂ ਤੁਸੀਂ ਆਹ ਨਵਾਂ ਬੱਸ ਸਟੈਂਡ ਬਣਿਆ ਸਾਡਾ ਟਿਬੜੀ ਰੋਡ 'ਤੇ ਉੱਥੇ ਜਾਓ ਤੁਸੀਂ ਉੱਥੇ ਕਨੈਕਟਰ ਨਾਲ ਗੱਲ ਕਰੋ ਤੁਹਾਨੂੰ ਦੱਸ ਦੇਣਗੇ ਇੱਕ ਘੰਟੇ ਦਾ ਹੈਗਾ ਜੇ ਉੱਥੇ ਨਾ ਗੁਰੂ ਨਾਨਕ ਦੇਵ ਜੀ ਦਾ ਚੋਲਾ ਪਾਇਆ ਹੋਇਆ ਉੱਥੇ ਉਨ ਉੱਥੇ ਰੱਖਿਆ ਹੋਇਆ ਉਹਨਾਂ ਨੇ ਉਹਦੇ ਦਰਸ਼ਨ ਕਰਨ ਲਈ ਕਰਨ ਜਾਂਦੇ ਆ ਲੋਕ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਕ ਘੰਟੇ ਦਾ ਡੇਰਾ ਬਾਬਾ ਨਾਨਕ ਜਾਣਾ